ਮਨੁੱਖ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜਨਾ ਚਾਹੁੰਦਾ ਹੈ ਇਹ ਬਾਕਈ ਇੱਕ ਸੱਚਾਈ ਹੈ ਹਰ ਮਨੁਸ਼ ਚਾਹੁੰਦਾ ਹੈ ਕਿ ਉਹ ਆਪਣੀਆਂ ਜੜ੍ਹਾਂ ਨਾਲ ਹਮੇਸ਼ਾ ਜੁੜਿਆ ਰਹੇ ਮੈਨੂੰ ਵੀ ਇੱਕ ਗੱਲ ਯਾਦ ਹੈ ਜੋ ਮੇਰੇ ਮਾਤਾ ਪਿਤਾ ਨੇ ਮੈਨੂੰ ਬਚਪਨ 'ਚ ਸਿਖਾਈ ਸੀ ਮੈਂ ਆਪਣੀ ਭੈਣ ਦੇ ਨਾਲ ਕਿਸੇ ਉਹਨਾਂ ਦੀ ਸਹੇਲੀ ਦੇ ਘਰ ਗਈ ਉੱਥੋਂ ਮੈਂ ਇੱਕ ਪੈਨਸਲ ਚੁੱਕ ਕੇ ਲਿਆਂਦੀ ਉਹ ਪੈਨਸਲ ਸੀ ਉਹਨਾਂ ਦੇ ਘਰ 'ਚ ਪਈ ਸੀ ਮੈਂ ਇਸ ਤਰ੍ਹਾਂ ਹੀ ਉਹਨਾਂ ਦੇ ਘਰੋਂ ਚੁੱਕ ਲਿਆਈ ਜਦੋਂ ਮੈਂ ਘਰ ਆਈ ਮੇਰੇ ਪਿਤਾ ਜੀ ਨੂੰ ਪਤਾ ਲੱਗਿਆ ਕਿ ਮੈਂ ਉਹ ਪੈਂਸਲ ਚੁੱਕ ਕੇ ਲਿਆਈ ਹਾਂ ਉਹਨਾਂ ਨੇ ਮੇਰੇ 'ਤੇ ਬਹੁਤ ਗੁੱਸਾ ਕੀਤਾ ਉਹ ਗੱਲ ਮੇਰੇ ਦਿਮਾਗ ਦੇ ਵਿੱਚ ਐਸੀ ਪਈ ਐਸੀ ਪਈ ਕਿ ਉਸ ਦਿਨ ਤੋਂ ਬਾਅਦ ਮੇਰੇ ਮਨ ਦੇ ਵਿੱਚ ਸਦਾ ਲਈ ਸੱਚਾਈ ਅਤੇ ਇਮਾਨਦਾਰੀ ਆ ਗਈ ਅੱਜ ਦੇ ਜ਼ਮਾਨੇ 'ਚ ਵੀ ਅਸੀਂ ਕਦੇ ਕਿਸੇ ਕੋਲੋਂ ਕੁਛ ਲੈਣ ਦੇਣ ਕਰਨਾ ਹੋਵੇ ਕੁਛ ਹੋਵੇ ਉਹ ਐਸੀ ਮੇਰੀ ਜੜ੍ਹਾਂ 'ਚ ਛੁਪੀ ਹੈ ਉਹ ਚੀਜ਼ ਕਿ ਇਮਾਨਦਾਰੀ ਅਤੇ ਸੱਚਾਈ ਜੋ ਮੇਰੇ ਪਿਤਾ ਅੱਜ ਦੁਨੀਆ 'ਤੇ ਨਹੀਂ ਵੀ ਰਹੇ ਫਿਰ ਵੀ ਹਰ ਪਲ ਮੈਨੂੰ ਉਹ ਗੱਲ ਯਾਦ ਆਉਂਦੀ ਹੈ ਅਗਰ ਮੈਂ ਕਿਸੇ ਦਾ ਇੱਕ ਰੁਪਿਆ ਵੀ ਦੇਣਾ ਹੋਏ ਐਸੀ ਜੜ੍ਹਾਂ ਨਾਲ ਜੁੜੀ ਗੱਲ ਹੈ ਕਿ ਹਮੇਸ਼ਾ ਯਾਦ ਰਹਿੰਦਾ ਹੈ ਕਿ ਨਹੀਂ ਮੈਂ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਇਸ ਕਰਕੇ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ ਅਤੇ ਉਹਨਾਂ ਤੋਂ ਕੋਈ ਨਾ ਕੋਈ ਸਿੱਖਿਆ ਚੰਗੀ ਜ਼ਰੂਰ ਸਿੱਖੋ ਤਾਂ ਕਿ ਉਹ ਸਾਡੇ ਸਾਰੇ ਜੀਵਨ ਲਈ ਸਾਡੇ ਲਈ ਸਬਕ ਬਣ ਜਾਏ